ਸਾਡੇ ਖੇਤਰ ਵਿੱਚ ਕਈ ਧਾਰਮਿਕ ਸਥਾਨ ਨੇ ਜਿਨਾਂ ਦੀਆਂ ਆਪੋ ਆਪਣੇ ਸਮਿਆਂ ਦੇ ਹਿਸਾਬ ਨਾਲ ਕਈ ਤੀਰਥ ਯਾਤਰਾਵਾਂ ਨਿਕਲਦੀਆਂ ਰਹਿੰਦੀਆਂ ਨੇ ਪਹਿਲਾਂ ਗੱਲ ਕਰੀਏ ਤਾਂ ਆਪਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਜਿ ਜਿੱਥੇ ਗੁਰੂ ਰਾਮਦਾਸ ਜੀ ਦੀ ਨਗਰੀ ਵੀ ਕਿਹਾ ਜਾਂਦਾ ਹੈ ਉੱਥੇ ਹੀ ਸਾਜ ਲੱਖਾਂ ਦੇ ਹਿਸਾਬ ਨਾਲ ਤਦਾਦ ਦੇ ਹਿਸਾਬ ਨਾਲ ਸੰਗਤਾਂ ਰੋਜ਼ ਦਰਸ਼ਨ ਕਰਦੀਆਂ ਨੇ ਸ਼੍ਰੀ ਦਰਬਾਰ ਸਾਹਿਬ ਗੁਰੂ ਰਾਮਦਾਸ ਦੀ ਨਗਰੀ ਵਿੱਚ ਜਦੋਂ ਜਿਹੜਾ ਗੁਰਦੁਆਰਾ ਸਾਹਿਬ ਮੇਨ ਨੇ ਉੱਥੇ ਉਹਨਾਂ ਨੇ ਚਾਰੇ ਦਿਸ਼ਾਵਾਂ ਵਿੱਚ ਦਰਵਾਜ਼ੇ ਰੱਖੇ ਨੇ ਜੋ ਗੁਰੂ ਜੀ ਨੇ ਕਿਹਾ ਸੀ ਕਿ ਇਹ ਸਾਰੇ ਧਰਮਾਂ ਲਈ ਖੁੱਲੇ ਨੇ ਉੱਥੇ ਕਿਸੇ ਵੀ ਤਰ੍ਹਾਂ ਦੇ ਕੋਈ ਜਾਤ ਧਰਮ ਦਾ ਪਾਬੰਦੀ ਨਹੀਂ ਹੈ ਉੱਥੇ ਸਾਰਿਆਂ ਨੂੰ ਇੱਕ ਸਮਾਨ ਹੀ ਸਮਝਿਆ ਜਾਂਦਾ ਹੈ ਗੁਰੂ ਦੇ ਘਰ ਦਰ ਪਰਕਰਮਾ ਕਰਕੇ ਇਸ਼ਨਾਨ ਕਰਕੇ ਪਰਕਰਮਾ ਕਰਕੇ ਪ੍ਰਸ਼ਾਦ ਲੈ ਕੇ ਉਹ ਦੇਗ ਪ੍ਰਸ਼ਾਦ ਲੈ ਕੇ ਉਸ ਤੋਂ ਬਾਅਦ ਗੁਰੂ ਦੇ ਲੰਗਰ ਵਿੱਚ ਪ੍ਰਸ਼ਾਦਾ ਛਕਿਆ ਜਾਂਦਾ ਹੈ ਜਿਹੜਾ ਸਾਰੇ ਧਰਮਾਂ ਵਾਸਤੇ ਇੱਕੋ ਬਰਾਬਰ ਹੈ ਉਸ ਤੋਂ ਸ਼੍ਰੀ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਵੀ ਗੁਰੂ ਸਿੱਖਾਂ ਦੀ ਜਨਮਭੂਮੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਉੱਥੇ ਵੀ ਸਾਰੇ ਧਰਮ ਹੀ ਮੰਨੇ ਜਾਂਦੇ ਆ ਉਥੋਂ ਦਾ ਖਾਸ ਤਿਉਹਾਰ ਹੋਲਾ ਮਹੱਲਾ ਸਾਹਿਬ ਹੈ ਜਿਹੜਾ ਕਿ ਜਿਹੜਾ ਕਿ ਫਰ ਮਾਰਚ ਦੇ ਮਹੀਨੇ ਵਿੱਚ ਆਉਂਦਾ ਹੈ ਸੰਗਤਾਂ ਕਾਫੀ ਦਰਸ਼ਨ ਕਾਫੀ ਦੂਰੋਂ ਦੂਰੋਂ ਦੂਰੋਂ ਨੇੜਿਓਂ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਨੇ ਉੱਥੇ ਕਾਫੀ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਨੇ ਲੰਗਰ ਲਗਾਏ ਜਾਂਦੇ ਨੇ ਸੰਗਤਾਂ ਦੂਰੋਂ ਨੇੜਿਓਂ ਆ ਕੇ ਗੁਰੂ ਦੇ ਗੁਰੂ ਦਾ ਅਸੀਸ ਪ੍ਰਾਪਤ ਕਰਦੀਆਂ ਨੇ ਉਸ ਤੋਂ ਬਾਅਦ ਉੱਤੇ ਨਾਲ ਹੀ ਮਾਤਾ ਨੈਣਾ ਦੇਵੀ ਦਾ ਮੰਦਰ ਹੈ ਜਿੱਥੇ ਕਿ ਕਾਫੀ ਤਰ੍ਹਾਂ ਦੇ ਕਾਫੀ ਤਰ੍ਹਾਂ ਕਾਫੀ ਲੋਕ ਸੰਗਤਾਂ ਦਰਸ਼ਨ ਕਰਨ ਜਾਂਦੀਆਂ ਨੇ ਮਾਤਾ ਨੈਣਾ ਦੇਵੀ ਦੇ ਉੱਥੇ ਵੀ ਕਈ ਤਰ੍ਹਾਂ ਦੇ ਜਿੱਦਾਂ ਕਿ ਚਾਲੇ ਚਲਦੇ ਨੇ ਰਾਹ ਵਿੱਚ ਬਹੁਤ ਲੰਗਰ ਲੱਗਦੇ ਨੇ ਸੰਗਤਾਂ ਦੂਰੋਂ ਨੇੜਿਓਂ ਆ ਕੇ ਦਰਸ਼ਨ ਕਰਦੀਆਂ ਮਾਤਾ ਦੇ ਅਸੀਸ ਪ੍ਰਾਪਤ ਕਰਦੀਆਂ ਨੇ ਇਸ ਤਰ੍ਹਾਂ ਹੀ ਕਈ ਤਰ੍ਹਾਂ ਦੇ ਕਈ ਤਿਉਹਾਰ ਮਨਾਏ ਜਾਂਦੇ ਨੇ ਸਾਰੇ ਧਰਮਾਂ ਦਾ ਆਪੋ ਆਪਣਾ ਸਥਾਨ ਹੈ ਇਸ ਤੋਂ ਇਲਾਵਾ ਅਸੀਂ ਕਈ ਧਰਮਿਕ ਸਥਾਨਾਂ ਦਾ ਅਭਿਆਸ ਹੈ ਜਿਹੜਾ ਕਿ ਅਸੀਂ ਕਈ ਧਾਰਮਿਕ ਸਥਾਨਾਂ ਦੇ ਜਾਂ ਦਰਸ਼ਨ ਕਰਨਾ ਪਸੰਦ ਕਰਦੇ ਹਾਂ ਸਾਨੂੰ ਸਾਰੇ ਧਰਮ ਇੱਕੋ ਬਰਾਬਰ ਰੱਖਣੇ ਚਾਹੀਦੇ ਨੇ ਸਾਰੇ ਧਰਮਾਂ ਦਾ ਅਸੀਸ ਲੈਣੀ ਚਾਹੀਦੀ ਹੈ ਸਾਰੇ ਧਰਮ ਇੱਕੋ ਜਿਹੇ ਹੀ ਹਨ ਕਿਸੇ ਵੀ ਧਰਮ ਵਿੱਚ ਕੋਈ ਭੇਦਭਾਵ ਨਹੀਂ ਕਰਨਾ ਚਾਹੀਦਾ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਨਾ ਚਾਹੀਦਾ ਹੈ